ਹੈਲੋ ਚੋਪੜਾ ਟੈਕਸੀ ਸਰਵਿਸ ਸਰਹਿੰਦ ਤੋਂ ਬੋਲ ਰਹੇ ਹੋ ਅਸਲ 'ਚ ਮੈਂ ਚਾਰ ਤਰੀਕ ਦੀ ਅਸੀਂ ਗੱਡੀ ਬੁੱਕ ਕਰਨੀ ਹੈ ਦਿੱਲੀ ਜਾਣ ਲਈ ਏਅਰਪੋਰਟ 'ਤੇ ਅਤੇ ਮੈਂ ਤੁਹਾਡੇ ਪਿਛਲੇ ਡਰਾਈਵਰ ਸਤਵੰਤ ਸਿੰਘ ਨਾਲ ਵੀ ਗੱਲ ਕਰਕੇ ਹਟੀ ਹਾਂ ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਛੱਡ ਚੁੱਕੇ ਨੇ ਅਤੇ ਜਿਹੜੀ ਤੁਹਾਡੀ ਟੈਕਸੀ ਸਰਵਿਸ ਕੰਪਨੀ ਹੈ ਉਹ ਹੁਣ ਸੈਵੰਟੀ ਫਾਈਵ ਪ੍ਰਸੈਂਟ ਪਹਿਲਾਂ ਐਡਵਾਂਸ ਲੈਂਦੇ ਆ ਅਤੇ ਫਿਰ ਜ ਡੈਸਟੀਨੇਸ਼ਨ 'ਤੇ ਪਹੁੰਚ ਕੇ ਉੱਥੇ ਬਾਕੀ ਦਾ ਤੁਸੀਂ ਕੈਸ਼ ਲੈਂਦੇ ਹੋ ਅਤੇ ਮੈਂ ਇਹ ਪੁੱਛਣਾ ਸੀ ਵੀ ਅਸੀਂ ਪਿਛਲੀ ਵਾਰ ਸਿੱਧਾ ਉੱਥੇ ਜਾ ਕੇ ਹੀ ਕੈਸ਼ ਦਿੱਤਾ ਸੀ ਬਟ ਇਸ ਟਾਈਮ ਇੱਦਾਂ ਅਸੀਂ ਕਰ ਸਕਦੇ ਹਾਂ ਵੀ ਅਸੀਂ ਫਿਫਟੀ ਪ੍ਰਸੈਂਟ ਤੁਹਾਨੂੰ ਔਨਲਾਈਨ ਟ੍ਰਾਜੈਕਸ਼ਨ ਕਰ ਦਿੰਦੇ ਹਾਂ ਅਤੇ ਫਿਫਟੀ ਪ੍ਰਸੈਂਟ ਅਸੀਂ ਦਿੱਲੀ ਪਹੁੰਚ ਕੇ ਤੁਹਾਨੂੰ ਪੇਮੈਂਟ ਕਰ ਦਾਂਗੇ ਨਕਦ ਅਤੇ ਸਾਨੂੰ ਇਨੋਵਾ ਗੱਡੀ ਚਾਹੀਦੀ ਹੈ ਕਿਉਂਕਿ ਸਾਡੇ ਕੋਲ ਸਵਾਰੀਆਂ ਜ਼ਿਆਦਾ ਨੇ ਲਗਭਗ ਸਾਡੇ ਕੋਲ ਸਵਾਰੀਆਂ ਛੇ ਦੇ ਕਰੀਬ ਹੈ ਅਤੇ ਜੇ ਛੇ ਸਵਾਰੀਆਂ ਨੇ ਤਾਂ ਏਅਰਪੋਰਟ 'ਤੇ ਜਾਣਾ ਤਾਂ ਟੈਚੀ ਵੀ ਹੋਣਗੇ ਤਾਂ ਟੈਚੀ ਸਾਡੇ ਕੋਲ ਛੇ ਸੱਤ ਨੇ ਤਾਂ ਇਸ ਕਰਕੇ ਜਿਹੜਾ ਵੀ ਡਰਾਈਵਰ ਭੇਜੋਂਗੇ ਉਹਨੂੰ ਕਿਹੋ ਵੀ ਕੈਰੀਅਰ ਨਾਲ ਹੋਵੇ ਅਤੇ ਉੱਪਰੋਂ ਐਕਸਪੀਰੀਅੰਸਡ ਹੋਵੇ ਉਹ ਨਾ ਕੋਈ ਨਸ਼ਾ ਪੱਤਾ ਕਰਦਾ ਹੋਵੇ ਅਤੇ ਕੋਈ ਭਰੋਸੇਮੰਦ ਬੰਦਾ ਭੇਜਿਓ